ਜੀ ਹਾਂ ਮੈਂ ਫੋਟੋਗ੍ਰਾਫੀ ਕਰਵਾਉਣ ਲਈ ਇੱਕ ਵਾਰ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਦੀ ਯਾਤਰਾ 'ਤੇ ਗਈ ਸੀ ਉੱਥੇ ਹਰਿਮੰਦਰ ਸਾਹਿਬ ਵਿਖੇ ਮੈਂ ਸੁਣਿਆ ਹੈ ਕਿ ਜਦੋਂ ਧੁੱਪ ਦਾ ਲਿਸ਼ਕਾਰਾ ਹਰਿਮੰਦਰ ਸਾਹਿਬ ਦੀ ਬਿਲਡਿੰਗ 'ਤੇ ਪੈਂਦਾ ਹੈ ਤਾਂ ਬੜਾ ਹੀ ਸੋਹਣਾ ਅਨੁਭਵ ਹੁੰਦਾ ਹੈ ਉੱਥੇ ਫੋਟੋਆਂ ਬਹੁਤ ਹੀ ਸੋਹਣੀਆਂ ਆਉਂਦੀਆਂ ਹਨ ਪਹਿਲਾਂ ਤਾਂ ਅਸੀਂ ਅੰਮ੍ਰਿਤਸਰ ਦੇ ਗੇਟ 'ਤੇ ਬਹੁਤ ਸੋਹਣੀਆਂ ਫੋਟੋਆਂ ਖਿੱਚੀਆਂ ਫਿਰ ਜਦੋਂ ਅਸੀਂ ਅੰਦਰ ਗਏ ਤਾਂ ਹਰਿਮੰਦਰ ਸਾਹਿਬ ਦੇ ਗੇਟ 'ਤੇ ਅਸੀਂ ਬਹੁਤ ਸੋਹਣੀਆਂ ਫੋਟੋਆਂ ਖਿੱਚੀਆਂ ਅੰਦਰ ਜੋੜਾ ਘਰ ਵਿਖੇ ਇੱਕ ਵੱਡਾ ਸਾਰਾ ਵਿਹੜਾ ਸੀ ਜਿੱਥੇ ਬਹੁਤ ਸੋਹਣੀਆਂ ਫੋਟੋਆਂ ਆਉਂਦੀਆਂ ਸੀਗੀਆਂ ਅਸਮਾਨ ਦੀਆਂ ਕਬੂਤਰ ਦੇ ਉੱਡਣ ਦੀਆਂ ਅਤੇ ਹੋਰ ਵੀ ਜਗ੍ਹਾ ਅੰਦਰ ਜਾ ਕੇ ਜਦੋਂ ਅਸੀਂ ਵੇਖਿਆ ਤਾਂ ਸਰੋਵਰ ਦੇ ਪਾਣੀ ਉੱਤੇ ਜਦੋਂ ਧੁੱਪ ਦਾ ਲਿਸ਼ਕਾਰਾ ਪੈਂਦਾ ਸੀ ਤਾਂ ਬੜਾ ਸੋਹਣਾ ਅਨੁਭਵ ਹੁੰਦਾ ਸੀ ਅਸੀਂ ਫੋਟੋਆਂ ਖਿੱਚੀਆਂ ਹਰਿਮੰਦਰ ਸਾਹਿਬ ਦੀ ਪੌੜੀਆਂ 'ਚ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਕੋਲ ਗੁਰੂ ਨਾਨਕ ਦੇਵ ਜੀ ਦੇ ਬੇਰੀ ਸਾਹਿਬ ਦੇ ਕੋਲ ਉੱਥੇ ਇਹਨਾਂ ਜਗਾਂਵਾਂ ਦੇ ਉੱਤੇ ਬਹੁਤ ਸੋਹਣੀਆਂ ਫੋਟੋਆਂ ਆਈਆਂ ਫਿਰ ਜਦੋਂ ਅਸੀਂ ਮੰਦਿਰ ਦੇ ਅੰਦਰ ਵੜੇ ਤਾਂ ਅਸੀਂ ਦੇਖਿਆ ਬੜੀ ਸੋਹਣੀ ਸਜਾਵਟ ਹੋਈ ਹੋਈ ਸੀ ਚੰਦੋਆ ਸਾਹਿਬ ਬੜੇ ਸੋਹਣੇ ਲੱਗ ਰਹੇ ਸਨ ਕੁਛ ਚੰਦੋਆ ਸਾਹਿਬ ਦੀਆਂ ਫੋਟੋਆਂ ਖਿੱਚੀਆਂ ਫਿਰ ਅਸੀਂ ਚੋਲਾ ਸਾਹਿਬ ਦੀਆਂ ਫੋਟੋਆਂ ਖਿੱਚੀਆਂ ਬੜਾ ਸੋਹਣਾ ਅਨੁਭਵ ਸੀਗਾ